ਜੀ ਸਾਡੇ ਰੋਪੜ ਦੇ ਵਿੱਚ ਨਹਿਰ ਸਾਨੂੰ ਬਹੁਤ ਪਸੰਦ ਹੈ ਵੀ ਉਹਦੇ ਵਿੱਚ ਪਾਣੀ ਬਹੁਤ ਠੀਕ ਢੰਗ ਨਾਲ ਚੱਲਦਾ ਹੈ ਉਹਦੇ ਵਿੱਚ ਆਪਾਂ ਨੂੰ ਤੈਰਾਕੀ ਕਰਨ ਦੇ ਲਈ ਬਹੁਤ ਵਧੀਆ ਸਮਾਂ ਮਿਲਦਾ ਹਨ ਅਤੇ ਬਹੁਤ ਸਾਨੂੰ ਪਸੰਦ ਹਨ